ਹੈਲੋ ਕੀ ਹਾਲ ਚਾਲ ਹੈ ਬਸ ਹੋਰ ਕੀ ਕਰ ਰਹੇ ਸੀ ਅੱਜ ਅੱਛਾ ਲੈ ਮੈਨੂੰ ਵੀ ਦੱਸ ਦੇਣਾ ਸੀ ਮੈਂ ਵੀ ਚਲੀ ਜਾਂਦੀ ਫੇਰ ਕੌਣ ਕੌਣ ਆਏ ਸੀ ਕੌਣ ਕੌਣ ਅੱਛਾ ਲੈ ਤੂੰ ਮੈਨੂੰ ਕੋਲ ਹੀ ਕਰ ਦਿੰਦੇ ਅਸੀਂ ਮੈਂ ਆ ਜਾਂਦੀ ਜਲਦੀ ਅੱਛ ਸਿਵਲ ਹਸਪਤਾਲ ਅੱਛਾ ਅਤੇ ਇਹ ਕਿਹੜੀ ਅੱਛਾ ਅਤੇ ਮਤਲਬ ਪੰਜਾਬੀ ਮੂਵੀ 'ਚ ਸੀ ਕਰੀਨਾ ਵੀ ਹਾਂ ਅੱਛਾ ਅੱਛਾ ਅਤੇ ਫਿਰ ਕਿੱਦਾਂ ਜਿਹਾ ਲੱਗਦਾ ਸੀ ਦਿਲਜੀਤ ਅੱਛਾ ਫੋਟੋ ਫੂਟੋ ਖਿਚਵਾ ਲੈਣੀ ਸੀ ਫੋਟੋਸ ਨਹੀਂ ਲਿੱਤੀਆਂ

ਅੱਛਾ ਅਤੇ ਜਿੱਦਾਂ ਦਿਖਦਾ ਹੈ ਟੀ ਵੀ ਦੇ ਵਿੱਚ ਉਦਾਂ ਜਿਹਾ ਹੀ ਸੀ ਅੱਛਾ ਅੱਛਾ ਅੱਛਾ ਅੱਛਾ ਅੱਛਾ ਹਾਂ ਅਤੇ ਇਹ ਹਾਲੇ ਚੱਲਣੀ ਆ ਜਾਂ ਬਸ ਇੱਕ ਦਿਨ ਦਾ ਹੀ ਸੀ ਅੱਛਾ ਚਲੋ ਮੇਰੇ ਨਾਲ ਫੋਟੋ ਸ਼ੇਅਰ ਕਰਨਾ ਕਿ ਕਿੱਦਾਂ ਜੀ ਆਈ ਹੈ ਠੀਕ ਹੈ ਚਲੋ ਹਾਂ ਫਿਰ ਕਰਦੇ ਹਾਂ ਗੱਲ ਹੈ ਨਾ ਚਲੋ ਫਿਰ ਓਕੇ ਜੇ ਠੀਕ ਹੈ ਬਾਏ